ਅੰਮ੍ਰਿਤਸਰ ਵਿੱਚ ਜੋ ਉਦਯੋਗ ਕਾਰੋਬਾਰ ਹਨ ਉਹ ਕੱਪੜਾ ਮਿੱਲ ਖਰਾਦ ਸਮਾਸੀਬਲ ਪੰਪ ਅਤੇ ਪੱਖੇ ਅਤੇ ਹੋਰ ਵੀ ਨਿੱਕੇ ਮੋਟੇ ਕੰਮ ਰਹਿੰਦੇ ਹਨ ਜੋ ਕਾਫੀ ਮਹੱਤਵਪੂਰਨ ਹਨ ਇਹ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਹਨ ਜੋ ਕਿ ਹੁਣ ਐਕਸਪੋਰਟ ਇਮਪੋਰਟ ਵੀ ਆਪਾਂ ਇਸ ਨੂੰ ਆਪਾਂ ਕਰ ਰਹੇ ਹਨ ਕੱਪੜਾ ਮਿਲ ਜੋ ਕਿ ਓ ਸੀ ਐੱਮ ਦੀ ਅੰਮ੍ਰਿਤਸਰ ਦੀ ਸਭ ਤੋਂ ਮੰਨੀ ਗਈ ਹੈ ਇੱਥੇ ਕਾਫੀ ਵਧੀਆ ਤਰੀਕੇ ਦੇ ਨਾਲ ਕੰਮ ਕੀਤੇ ਜਾਂਦੇ ਹਨ ਸਮਰਸੀਬਲ ਪੰਪ ਜੋ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਬਣ ਕੇ ਕਈ ਖੇਤਰਾਂ ਦੇ ਵਿੱਚ ਜਾਂਦੇ ਹਨ ਖਰਾਦ ਦਾ ਕੰਮ ਜੋ ਸਪੇਅਰ ਪਾਰਟ ਹਨ ਉਹ ਕਾਫੀ ਹੱਦ ਤੱਕ ਇੱਥੋਂ ਅੰਮ੍ਰਿਤਸਰ ਦੇ ਵਿੱਚ ਬਣਦੇ ਹਨ ਅਤੇ ਕਈ ਜਗ੍ਹਾ 'ਤੇ ਪਹੁੰਚਦੇ ਹਨ ਇਹ ਕੰਮ ਨੂੰ ਹੁਣ ਅਸੀਂ ਕਾਫੀ

ਔਖਿਆਈ ਵੀ ਆ ਰਹੀ ਹਨ ਜੋ ਕਿ ਜਿਸ ਤਰ੍ਹਾਂ ਅਸੀਂ ਲੇਬਰ ਨੂੰ ਲੈ ਕੇ ਅਸੀਂ ਇੱਕ ਇਸ਼ੂ ਬਣ ਚੁੱਕਾ ਹੋਇਆ ਹੈ ਸਾਨੂੰ ਲੇਬਰ ਨਹੀਂ ਮਿਲ ਪਾ ਰਹੀ ਜਿਹਦੇ ਨਾਲ ਸਾਡਾ ਕੰਮ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ ਬੇਸ਼ੱਕ ਕਾਫੀ ਰੋਬੋਟ ਤਕਨੀਕਾਂ ਆ ਚੁੱਕੀਆਂ ਹਨ ਜਿਹਦੇ ਨਾਲ ਸਾਨੂੰ ਕਾਫੀ ਆਸਾਨੀ ਹੈ ਲੇਕਿਨ ਮੈਨੂਅਲੀ ਕੰਮ ਜੋ ਸਾਨੂੰ ਚਾਹੀਦੇ ਨੇ ਜੋ ਹੱਥੀਂ ਕੰਮ ਕਰਨ ਵਾਸਤੇ ਸਾਨੂੰ ਲੋਕ ਚਾਹੀਦੇ ਨੇ ਉਹ ਕਾਫੀ ਮੁਸ਼ਕਿਲ ਦੇ ਵਿੱਚ ਹੈ ਲੇਕਿਨ ਕਾਫੀ ਹੱਦ ਤੱਕ ਲੋਕਾਂ ਨੇ ਇਸ ਚੀਜ਼ ਨੂੰ ਵੀ ਆਪਣੇ ਤਰੀਕੇ ਦੇ ਨਾਲ ਢਾਲਿਆ ਹੋਇਆ ਅਤੇ ਇਹ ਕੰਮ ਹੁਣ ਕਾਫੀ ਵਿਕਸਿਤ ਹੋ ਚੁੱਕੇ ਹਨ ਅਤੇ ਕਈ ਖੇਤਰਾਂ ਦੇ ਵਿੱਚ ਅੰਮ੍ਰਿਤਸਰ ਤੋਂ ਸਮਾਨ ਜਾਂਦਾ ਆਉਂਦਾ ਹੈ